ਹਾਂਜੀ ਬਿਲਕੁਲ ਪੰਜਾਬ ਦੇ ਵਿੱਚ ਸਕੂਲਾਂ ਦੇ ਵਿੱਚ ਬੱਚਿਆਂ ਨੂੰ ਕਾਫ਼ੀ ਰੇਸਿਸ ਕਰਵਾਈਆਂ ਜਾਂਦੀਆਂ ਨੇ ਉਹਨਾਂ ਦੇ ਸਿਰ ਕਿ ਜਦੋਂ ਚਿਲਡਰਨਜ਼ ਸਪੋਰਟਸ ਡੇ ਹੁੰਦਾ ਤਾਂ ਸਪੋਰਟਸ ਡੇ ਦੇ ਵਿੱਚ ਉਹਨਾਂ ਦੇ ਲਈ ਛੋਟੀਆਂ ਛੋਟੀਆਂ ਗੇਮਸ ਰੱਖੀਆਂ ਜਾਂਦੀਆਂ ਗੇਮਸ ਪੀਰੀਅਡ ਹੁੰਦਾ ਗੇਮਸ ਪੀਰੀਅਡ ਦੇ ਵਿੱਚ ਉਹਨਾਂ ਨੂੰ ਪ੍ਰੈਫਰ ਕੀਤਾ ਜਾਂਦਾ ਕਿ ਤੁਸੀਂ ਟੂ ਹੰਡਰਡ ਮੀਟਰ ਰੇਸ ਦੋੜੋ ਜਾਂ ਹੰਡਰਡ ਮੀਟਰ ਰੇਸ ਜਾਂ ਫ਼ੋਰ ਹੰਡਰਡ ਮੀਟਰ ਰੇਟ ਹੰਡਰਡ ਮੀਟਰ ਰੇਸ ਦੇ ਵਿੱਚ ਪਾਰਟੀਸਪੇਟ ਕਰਨ ਤਾਂ ਕਿ ਬੱਚੇ ਜਿਹੜੇ ਨੇ ਹੈਲਦੀ ਰਹਿਣ ਕਿਉਂਕਿ ਜਦੋਂ ਬੱਚੇ ਗੇਮਸ ਦੇ ਵਿੱਚ ਪਾਰਟੀਸਪੇਟ ਕਰਨਗੇ ਥੋੜ੍ਹਾ ਬਹੁਤਾ ਦੌੜਨਾ ਸ਼ੁਰੂ ਕਰਨਗੇ ਤਾਂ ਉਹਨਾਂ ਦੀ ਹੈਲਥ ਜਿਹੜੀ ਆ ਉਹ ਬੜੀ ਫਿੱਟ ਰਹਿੰਦੀ ਆ ਉਹਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਬਿਮਾਰੀ ਨਹੀਂ ਲੱਗਦੀ ਹੈਗੀ ਜਿੱਦਾਂ ਕਿ ਅੱਜ ਕੱਲ੍ਹ ਬੱਚੇ ਜਿਹੜੇ ਨੇ ਉਹ ਮੋਸਟਲੀ ਕੀ ਹੈ ਕਿ ਫੋਨ ਦੇ ਵਿੱਚ ਜ਼ਿਆਦਾ ਇਨਵੋਲਵਡ ਰਹਿੰਦੇ ਨੇ ਘਰ ਵੀ ਆ ਗਏ ਤਾਂ ਫੋਨ ਦੇਖਣਾ ਸ਼ੁਰੂ ਕਰ ਦਿੱਤਾ ਫੋਨ ਦੇਖਣ ਕਰਕੇ ਉਹ ਮਤਲਬ ਔਰ ਉਹਨਾਂ ਦੀ ਡਾਇਟਸ ਵੀ ਉੱਦਾਂ ਦੀਆਂ ਹੀ ਨੇ ਕਿ ਮੈਗੀ ਖਾ ਲਈ ਪੀਜ਼ਾ ਖਾ ਲਿਆ ਪਾਸਤਾ ਖਾ ਲਿਆ ਤਾਂ ਉਹਦੇ ਕਰਕੇ ਕੀ ਹੁੰਦਾ ਕਿ ਉਹ ਮੈਦਾ ਜ਼ਿਆਦਾ ਆਪਣੀ ਡਾਇਟ ਦੇ ਵਿੱਚ ਇੰਨਕਲਿਊਡ ਕਰ ਰਿਹਾ ਤਾਂ ਉਹਨਾਂ ਦੀ ਹੈਲਥ ਜਿਹੜੀ ਉਹ ਹੌਲੀ ਹੌਲੀ ਹੌਲੀ ਹੌਲੀ ਵਿਗੜਦੀ ਜਾ ਰਹੀ ਹੈ ਲੀਵਰ ਖ਼ਰਾਬ ਹੋ ਰਹੇ ਨੇ ਡਾਇਬਿਟਿਕ ਹੋ ਰਹੇ ਨੇ ਬਟ ਜਿਹੜੀ ਇੱਕ ਦੋੜਨਾ ਹੈਗਾ ਉਹ ਜਦੋਂ ਸ਼ਾਮ ਨੂੰ ਖੇਡਦੇ ਨੇ ਜਾਂ ਸਪੋਰਟਸ ਡੇ ਦੇ ਵਿੱਚ ਚਲੋ ਰੇਸਿਸ ਹੁੰਦੀਆਂ ਨੇ ਜਾਂ ਫਿਰ ਗੇਮਸ ਪੀਰੀਅਡ ਦੇ ਵਿੱਚ ਜਦੋਂ ਖੇਡਣਾ ਸ਼ੁਰੂ ਕਰਦੇ ਨੇ ਤਾਂ ਉਹਨਾਂ ਦੀ ਹੈਲਤ ਨੂੰ ਜਿਹੜਾ ਉਹ ਫਿੱਟ ਰੱਖਦਾ ਤੋ ਇੱਕ ਤਰ੍ਹਾਂ ਦੀ ਐਕਸਰਸਾਈਜ਼ ਹੋ ਜਾਂਦੀ ਹੈ ਤਾਂ ਕਿ ਬੱਚੇ ਜਿਹੜੇ ਨੇ ਉਹ ਆਪਣਾ ਧਿਆਨ ਰੱਖ ਸਕਣ ਉਹਨਾਂ ਦੀ ਸਿਹਤ ਵਧੀਆ ਰਹੇ ਕਿਸੇ ਤਰ੍ਹਾਂ ਦੀਆਂ ਵੀ ਉਹਨਾਂ ਨੂੰ ਬਿਮਾਰੀਆਂ ਨਾ ਹੋਣ